ਹਾਈਕਿੰਗ ਦੇ ਲਈ ਮੇਰੀ ਮੇਰਾ ਮਨ ਪਸੰਦ ਦਾ ਇਲਾਕਾ ਹੈਗਾ ਪਹਾੜਾਂ ਵਾਲੇ ਜੰਗਲ ਪਹਾੜਾਂ ਵਾਲੇ ਜੰਗਲ ਹੀ ਮੇਰੀ ਪਸੰਦ ਇਸ ਲਈ ਹੈ ਕਿਉਂਕਿ ਪਹਿਲਾਂ ਤਾਂ ਚੜਾਈ ਕਰਦੇ ਹਾਂ ਅਸੀਂ ਜੰਗਲਾਂ ਦੇ ਵਿੱਚੋਂ ਦੀ ਨਿਕਲ ਕੇ ਜੰਗਲਾਂ ਦੇ ਵਿੱਚ ਇੱਕ ਸਾਡੀ ਪਿਕਨਿਕ ਵੀ ਮਨਾਈ ਜਾਂਦੀ ਹੈ ਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਰੁੱਖ ਹੁੰਦੇ ਨੇ ਰੁੱਖਾਂ ਦੇ ਉੱਪਰ ਪੰਛੀ ਬਹਿੰਦੇ ਨੇ ਅਤੇ ਜਾਨਵਰ ਵੀ ਹੁੰਦੇ ਨੇ ਉੱਥੇ ਕਈ ਤਰ੍ਹਾਂ ਦੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਮਨ ਨੂੰ ਸਕੂਨ ਦਿੰਦੀਆਂ ਨੇ ਤੁਰਦੇ ਤੁਰਦੇ ਜਾਂਦੇ ਹਾਂ ਅਸੀਂ ਕਈ ਵਾਰੀ ਹਾਈਕਿੰਗ ਦੇ ਉੱਤੇ ਆਪਣੇ ਸਾਈਕਲ ਵੀ ਲੈ ਜਾਂਦੇ ਹਾਂ ਕਿਉਂਕਿ ਵਧੀਆਂ ਲੱਗਦਾ ਕਦੇ ਸਾਈਕਲ 'ਤੇ ਅਸੀਂ ਰੇਸ ਲਗਾਈ ਦੀ ਆ ਕਦੇ ਤੁਰ ਕੇ ਜਾਈਦਾ ਹੈ ਆਹ ਦੇਖੀ ਦਾ ਕਿ ਕੌਣ ਪਹਿਲਾਂ ਚੜੇਗਾ ਕੌਣ ਪਹਿਲਾਂ ਜਾਵੇਗਾ ਫਿਰ ਪਹਾੜੀ 'ਤੇ ਉੱਚੇ ਪੀਕ 'ਤੇ ਜਾ ਕੇ ਉੱਥੇ ਮੌਜ ਮਸਤੀ ਕਰਕੇ ਫਿਰ ਅਸੀਂ ਨੀਚੇ ਨੂੰ ਆਈਦਾ ਹੈ ਆ ਨੀਚੇ ਆਉਂਦੇ ਵੀ ਅਸੀਂ ਕਈ ਤਰ੍ਹਾਂ ਦੀਆਂ ਮਸਤੀਆਂ ਕਰਦੇ ਹਾਂ ਪਹਾੜ ਵੀ ਵਧੀਆ ਲੱਗਦੇ ਨੇ ਪਰ ਜੇ ਉੱਥੇ ਜੰਗਲ ਸੰਘਣੇ ਹੋਣ ਤਾਂ ਉਹ ਇੱਕ ਅਲੱਗ ਤਰ੍ਹਾਂ ਦੀ ਹੀ ਆਨੰਦ ਦਿੰਦੇ ਨੇ ਅਤੇ ਮੈਨੂੰ ਬਰਫ਼ੀਲੇ ਪਹਾੜ ਜਾਂ ਸੰਘਣੇ ਜੰਗਲ ਜਾਂ ਸੂਰਜ ਡੁੱਬਣ ਇਹਨਾਂ ਦੇ ਵਿੱਚੋਂ ਮੈਨੂੰ ਸੂਰਜ ਡੁੱਬਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਇੱਕ ਤਰ੍ਹਾਂ ਦਾ ਇਹ ਪ੍ਰਤੀਕ ਦਿੰਦੇ ਨੇ ਜਦੋਂ ਸੂਰਜ ਡੁੱਬਦਾ ਤਾਂ ਉਦੋਂ ਆਪਾਂ ਨੂੰ ਇਹ ਸਮਝਦੇ ਹਾਂ ਕਿ ਹਾਂ ਸਾਰਾ ਕੁਛ ਖ਼ਤਮ ਰਾਤ ਪੈ ਗਈ ਪਰ ਨਹੀਂ ਇੱਕ ਆਸ ਹੁੰਦੀ ਹੈ ਕਿ ਸਵੇਰੇ ਸੂਰਜ ਫਿਰ ਚੜੇਗਾ ਸੋ ਇੱਕ ਤਰ੍ਹਾਂ ਦਾ ਇਹ ਆਪਣੀ ਜ਼ਿੰਦਗੀ ਦੇ ਨਾਲ ਵੀ ਨਿਰਭਰ ਕਰਦਾ ਹੈ ਆ ਹੈ ਹਰ ਵਾਰੀ ਜੇ ਕੋਈ ਗਮ ਆਉਂਦਾ ਕੋਈ ਦੁੱਖ ਹੁੰਦਾ ਤਾਂ ਉਹਨੇ ਇੱਕ ਵਾਰੀ ਆਉਣਾ ਬਾਅਦ ਚੋਂ ਚਲੇ ਜਾਣਾ ਅਤੇ ਸੁੱਖ ਵੀ ਆ ਜਾਵੇਗਾ ਉੱਦਾਂ ਹੀ ਸੂਰਜ ਡੁੱਬਣ ਦਾ ਆ ਕਿ ਸੂਰਜ ਡੁੱਬਦਾ ਹੈ ਬਹੁਤ ਹੀ ਸੁਹਾਵਣਾ ਲੱਗਦਾ ਉਹ ਵੇਲਾ ਦ੍ਰਿਸ਼ ਦੇਖਣ ਵਾਲਾ ਹੁੰਦਾ ਉਹ ਜਦੋਂ ਸੂਰਜ ਡੁੱਬਦਾ ਅਤੇ ਸਵੇਰੇ ਫਿਰ ਉਹ ਸੂਰਜ ਆਪਣੇ ਤੰਦਰੁਸਤੀ ਦੇ ਵਿੱਚ ਚੜ ਜਾਂਦਾ ਹੈ ਸੋ ਇੱਕ ਤਰ੍ਹਾਂ ਦਾ ਪ੍ਰਤੀਕ ਦਿੰਦਾ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਆ ਸੋ ਹਾਈਕਿੰਗ ਦੇ ਲਈ ਮੈਨੂੰ ਲੱਗਦਾ ਹੈ ਕਿ ਪਹਾੜਾਂ ਵਾਲੇ ਜੰਗਲ ਹੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਇੱਕ ਤਾਂ ਬਰਫ਼ ਡਿੱਗਣ ਦਾ ਡਰ ਨਹੀਂ ਹੁੰਦਾ ਅਤੇ ਦੂਜਾ ਜੇ ਬਾਰਿਸ਼ ਆ ਜਾਂਦੀ ਹੈ ਤਾਂ ਰੁੱਖ ਸਾਨੂੰ ਬਾਰਿਸ਼ ਤੋਂ ਬਚਾ ਲੈਂਦੇ ਨੇ